ਹਾਂਜੀ ਅਸੀਂ ਨਾ ਸਕਰੈਪ ਜਿਹੜੀ ਐਪ ਹੈਗੀ ਸਕਰੈਚ ਐਪ ਦੇ ਵਿੱਚ ਅਸੀਂ ਬਹੁਤ ਕੁਝ ਦੇਖਿਆ ਹੈਗਾ ਅਤੇ ਬਹੁਤ ਕੁਝ ਇਸ ਦੇ ਵਿੱਚ ਡਿਸ਼ਾਂ ਬਣਾਉਣ ਵਾਸਤੇ ਦੱਸਦੇ ਹਨ ਅਤੇ ਜਦੋਂ ਵੀ ਸਾਡਾ ਕੋਈ ਮਨ ਕਰਦਾ ਕੁਝ ਵੀ ਚੀਜ਼ ਖਾਣ ਨੂੰ ਤਾਂ ਅਸੀਂ ਉਹਦੀ ਯੂਟੀਊਬ ਖੋਲ੍ਹ ਕੇ ਸਕਰੈਚ ਐਪ ਖੋਲ੍ਹ ਕੇ ਉਹਦੇ ਵਿੱਚ ਦੀ ਅਸੀਂ ਦੇਖਦੇ ਹੈਗੇ ਜਿਹੜੀ ਵੀ ਚੀਜ਼ ਕੋਈ ਮਨਪਸੰਦ ਦੀ ਹੁੰਦੀ ਹੈਗੀ ਉਹ ਖੋਲ੍ਹ ਕੇ ਉਹਦੀ ਸਾਰੀ ਐਪ ਜਿਹੜੀ ਡਾਊਨਲੋਡ ਕਰਕੇ ਸ ਦੇਖ ਕੇ ਅਸੀਂ ਬਣਾ ਲੈਂਦੇ ਹੈਗੇ ਸਾਡੇ ਨਾ ਘਰੇ ਇੱਕ ਦਿਨ ਰਿਸ਼ਤੇਦਾਰ ਆ ਗਏ ਅਤੇ ਉਹ ਰਿਸ਼ਤੇਦਾਰਾਂ ਨੇ ਮੋਮੋਜ ਖਾਣ ਦੀ ਡਿਮਾਂਡ ਕੀਤੀ ਫਿਰ ਅਸੀਂ ਉਹਨਾਂ ਵਾਸਤੇ ਸਾਨੂੰ ਘਰੇ ਖਵਾ ਬਣਾ ਕੇ ਖੁਆ ਕੇ ਦੇਖਦੇ ਆਂਗੇ ਅਤੇ ਸਾਨੂੰ ਸਕਰੈਪ ਦੇ ਵਿੱਚ ਸਾਰਾ ਕੁਝ ਵਧੀਆ ਦੱਸਿਆ ਉਸੇ ਤਰ੍ਹਾਂ ਹੀ ਅਸੀਂ ਉਵੇਂ ਉਵੇਂ ਬਣਾਈ ਗਏ ਅਤੇ ਬਹੁਤ ਟੇਸਟੀ ਅਤੇ ਇੰਨੇ ਜ਼ਿਆਦਾ ਵਧੀਆ ਬਣੇ ਹੈਗੇ ਜਿਵੇਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਪੱਤਾ ਗੋਭੀ ਅਤੇ ਜਿਹੜੇ ਬੁਰਾ ਬੜੀ ਸੀਗੇ ਉਹਨਾਂ ਨੂੰ ਉਬਾਲ ਕੇ ਬੋਇਲ ਕੀਤਾ ਗਾ ਉਹਨੂੰ ਬੋਇਲ ਕਰਕੇ ਫਿਰ ਅਸੀਂ ਉਸ ਤੋਂ ਬਾਅਦ ਇੱਕ ਮੈਦਾ ਲਿਆ ਮੈਦੇ ਨੂੰ ਗੁੰਨ ਕੇ ਰੱਖਤਾ ਸੀਗਾ ਥੋੜ੍ਹਾ ਜਿਹਾ ਲੂਣ ਪਾ ਕੇ ਉਹ 'ਚ ਗੁੰਨ ਕੇ ਰੱਖ ਤਾ ਉਹਨੂੰ ਫਿਰ ਉਹਨੂੰ ਅੱਡ ਗੁੰਨ ਕੇ ਰੱਖਿਆ ਉਹਦੇ ਨਿੱਕੀ ਨਿੱਕੀ ਗੋਲੀਆਂ ਬਣਾ ਕੇ ਉਹਨਾਂ ਨੂੰ ਮੋਮੋਜ ਦੇ ਵਿੱਚ ਜਿਹੜਾ ਬੋਇਲ ਕੀਤਾ ਵਾ ਸੀਗਾ ਉਸ ਦੇ ਵਿੱਚ ਥੋੜ੍ਹਾ ਜਿਹਾ ਨਮਕ ਮਿਰਚ ਪਾ ਕੇ ਆਪਦੇ ਟੇਸਟ ਅਨੁਸਾਰ ਜਿਵੇਂ ਦਾ ਉਹਨਾਂ ਨੇ ਖਾਣਾ ਸੀ ਉਹਦੇ ਨਾਲ ਟੇਸਟ ਅਨੁਸਾਰ ਵੀ ਉਵੇਂ ਦਾ ਬਣਾ ਕੇ ਮਿਕਸਚਰ ਜਿਹੜਾ ਸੀਗਾ ਸਾਰਾ ਫਿਰ ਉਹਨਾਂ 'ਚ ਭਰ ਭਰ ਕੇ ਅਤੇ ਇੱਕ ਨਾ ਸਟੀਮ ਕੀਤੇ ਫਿਰ ਉਹਨਾਂ ਨੂੰ ਜਿਹੜਾ ਥੱਲੇ ਗੈਸ ਲਾ ਕੇ ਇਲੈਕਟਰੋਨਿਕ ਚੁੱਲ੍ਹਾ ਗਾ ਉਹਦੇ 'ਤੇ ਰੱਖ ਕੇ ਫਿਰ ਨੀਚੇ ਪਾਣੀ ਪਾ ਕੇ ਇਕ ਟੱਬ ਤਿੰਨ ਟੱਬ ਹੁੰਦੇ ਉਹਨਾਂ ਨਾਲ ਇੱਕ ਟੱਬ ਥੱਲੇ ਰੱਖਿਆ ਸੀਗੇ ਉਹਦੇ 'ਚ ਪਾਣੀ ਵਾਲ ਸੀਗਾ ਅਤੇ ਫਿਰ ਉਸ ਦੇ ਵਿੱਚ ਜਿਹੜਾ ਉਹ ਇੱਕ ਉੱਪਰ ਮੋਰੀਆਂ ਜਿਹਾ ਵਾਲਾ ਹੁੰਦਾ ਗਾ ਟੱਬ ਉਹ ਰੱਖਿਆ ਉਹਦੇ ਵਿੱਚ ਜਿਹੜੇ ਮੋਮੋਜ ਪੈਕ ਕਰਕੇ ਤਿਆਰ ਕਰਕੇ ਰੱਖੇ ਸੀਗੇ ਅਤੇ ਉਹ ਉਹਦੇ ਉੱਤੇ ਰੱਖ ਕੇ ਸਾਰੇ ਫਿਰ ਉਹਨੂੰ ਢੱਕਤਾ ਅੱਧਾ ਪੌਣਾ ਘੰਟਾ ਉਹਨਾਂ ਨੂੰ ਬੋਇਲ ਹੋਈ ਗਿਆ ਪਾਣੀ ਬੋਇਲ ਹੋਈ ਗਿਆ ਪਾਣੀ ਬੋਇਲ ਹੋਣ ਤੋਂ ਬਾਅਦ ਫਿਰ ਉਹ ਵਧੀਆ ਸਟੀਮ ਹੋ ਗਿਆ ਉਹਨਾਂ ਨੂੰ ਸਟੀਮ ਕਰਨ ਤੋਂ ਬਾਅਦ ਉਹਨਾਂ ਨੂੰ ਸਟੀਮ ਕਰਨ ਤੋਂ ਬਾਅਦ ਫਿਰ ਉਹ ਜਦੋਂ ਉਹਨਾਂ ਦੀ ਇੱਕ ਚੱਟਨੀ ਅੱਡ ਬਣਾ ਲਈ ਸੀਗੀ ਰੈਡ ਸੋਸ ਬਣਾ ਲਈ ਸੀ ਟਮੈਟੋ ਨਾਲ ਟੋਮੈਟੋ ਨਾਲ ਸੋਸ ਬਣਾ ਕੇ ਉਹਦੀ ਬਹੁਤ ਟੇਸਟੀ ਬਣੀ ਸੀਗੀ ਅਤੇ ਟੋਮੈਟੋ ਸੋਸ ਵੀ ਉਹਨਾਂ ਨੂੰ ਨਾਲ ਅਲੱਗ ਬੋਇਲ ਕਰਕੇ ਅਤੇ ਉਹ ਚੀਜ਼ ਸਾਰੇ ਗਰਾਇੰਡ ਕਰਕੇ ਫਿਰ ਉਵੇਂ ਹੀ ਉਹ ਬਣਾਈ ਸਾਰੀ ਤਿਆਰ ਅਤੇ ਬਾਅਦ ਉਹ ਸੋਸ ਉਹ ਲਈ ਜਾਂਦੇ ਸੀਗੇ ਬਜ਼ਾਰੋਂ ਉਹ ਪਈ ਸੀ ਘਰੇ ਵੈਸੇ ਹੀ ਲਿਆਉਂਦੀ ਪਈ ਸੀਗੀ ਅਤੇ ਬਸ ਉਹ ਚੀਜ਼ ਸਾਰੀ ਉਹ ਤਿਆਰ ਕਰਕੇ ਨਾ ਮਿਕਸਰ ਜਿਹਾ ਫਿਰ ਉਹਨਾਂ ਸਾਰੇ ਰਿਸ਼ਤੇਦਰਾਂ ਨੂੰ ਖਵਾਇਆ ਅਤੇ ਉਹਨਾਂ ਨੇ ਬਹੁਤ ਜ਼ਿਆਦਾ ਟੇਸਟੀ ਲੱਗਿਆ ਅਤੇ ਫਿਰ ਉਹਨਾਂ ਨੇ ਇਹ ਚੀਜ਼ ਪੁੱਛੀ ਤੁਸੀਂ ਕਿੱਥੋਂ ਦੇਖ ਕੇ ਇਹ ਚੀਜ਼ ਬਣਾਈ ਹੈਗੀ ਅਤੇ ਅਸੀਂ ਫਿਰ ਉਹਨਾਂ ਨੂੰ ਦੱਸਿਆ ਕਿ ਅਸੀਂ ਸਕਰੈਚ ਐਪ ਤੋਂ ਦੇਖ ਕੇ ਸਾਰੇ ਹੀ ਜਿਹੜੇ ਇਹ ਚੀਜ਼ ਬਣਵਾਈ ਹੈਗੀ ਅਸੀਂ ਅਤੇ ਇਹ ਚੀਜ਼ ਤੋਂ ਬਹੁਤ ਵਧੀਆ ਚੀਜ਼ ਵੀ ਡਿਸ਼ਾਂ ਜਿਹੜੀ ਵੀ ਆਪਦੀ ਮਨਪਸੰਦ ਖਾਣ ਨੂੰ ਜੀ ਕਰਦਾ ਗਾ ਉਹੀ ਚੀਜ਼ ਦੇਖ ਕੇ ਅਸੀਂ ਉਸ ਤੋਂ ਬਣਵਾ ਸਕਦੇ ਹਾਂ